ਬ੍ਰਹਿਮੰਡ ਵਿੱਚ ਜਿੰਨੇ ਵੀ ਖੋਜ ਕਰ ਰਹੇ ਆ ਉਹ ਅਸਫਲ ਰਹੇ ਹੁਣ ਤੱਕ ਉੱਥੇ ਜੀਵ ਦੇ ਵਿੱਚ ਜੀਵ ਉਹਨਾਂ ਨੂੰ ਅਜੇ ਕੋਈ ਨਹੀਂ ਮਿਲ ਰਿਹਾ ਕੋਈ ਹੋਰ ਨਹੀਂ ਮਿਲ ਰਿਹਾ ਉੱਥੇ ਜੋ ਲੋਕ ਇਹ ਵੀ ਸੋਚਦੇ ਉਹ ਜੀ ਪਲਾਂਟ ਜ਼ਮੀਨ ਚੰਦ 'ਤੇ ਲੈ ਲਈਏ ਪਰ ਇੱਥੇ ਆਉਣਾ ਜਾਣਾ ਬੜਾ ਮੁਸ਼ਕਿਲ ਹੈ ਬਹੁਤ ਇੱਥੇ ਆਪਣੇ ਅੰਦਰ ਧਰਤੀ ਜ਼ਮੀਨ 'ਤੇ ਬਹੁਤ ਰਹਿਣਾ ਜਿਹੜਾ ਔਖਾ ਹੈਗਾ ਕਿਉਂਕਿ ਅੱਜ ਕੱਲ੍ਹ ਲੱਗਦਾ ਵੀਹ ਤੀਹ ਸਾਲ ਦੇ ਵਿੱਚ ਕੰਮ ਖਤਮ ਹੈ ਗਰਮੀ ਇੰਨੀ ਵੱਧ ਚੁੱਕੀ ਹੈ ਮਤਲਬ ਜਿਹੜਾ ਪਾਣੀ ਦਾ ਹੈਗਾ ਗੈਰਾਹ ਉਹ ਥੱਲੇ ਜਾ ਰਿਹਾ ਇਸ ਕਰਕੇ ਜਿਹੜਾ ਬ੍ਰਾਹਮੰਡ ਵੀ ਠੀਕ ਹੈ ਵਿਗਿਆਨੀ ਆਪਦੇ ਜੋ ਆਪਦੀ ਖੋਜ ਕਰ ਰਿਹਾ ਔਰ ਵਧੀਆ ਪਰ ਅਜੇ ਤੱਕ ਇਹ ਪੂਰਨ ਤੌਰ 'ਤੇ ਇਹ ਉੱਤੋਂ ਪੂਰੇ ਉੱਤਰ ਨਹੀਂ ਰਹੇ ਨਾ ਇਹਨਾਂ ਬਾਰੇ ਕੋਈ ਜਾਣਕਾਰੀ ਇਹਨਾਂ ਦਿੱਤੀ ਹੈ ਨਾ ਕੋਈ ਹੋਰ ਆਇਆ ਠੀਕ ਆ ਵੀ ਆਪਦੇ ਲੱਗੇ ਹੋਏ ਆ ਪਰ ਅਜੇ ਟਾਈਮ ਬਹੁਤ ਲੱਗੂਗਾ ਜਿਸ ਹਿਸਾਬ ਨਾਲ ਲੱਗਦਾ